ਹਾਂਜੀ ਮੈਂ ਇੱਕ ਵਾਰੀ ਮੇਰੇ ਇੱਕ ਫਰੈਂਡ ਨੂੰ ਪੁਰਾਣੀ ਫੋਟੋਆਂ ਦੀ ਕਟਿੰਗਸ ਕਰਕੇ ਅਤੇ ਉਹਦਾ ਕੋਲਾਜ ਬਣਾ ਕੇ ਉਹਨੂੰ ਫਰੇਮ ਕਰਾ ਕੇ ਉਹਨੂੰ ਉਹਦੇ ਬਰਡੇ 'ਤੇ ਗਿਫਟ ਦਿੱਤਾ ਸੀਗਾ ਅਤੇ ਇੱਕ ਗ੍ਰੀਟਿੰਗ ਕਾਰਡ ਵੀ ਅਸੀਂ ਮਤਲਬ ਬਣਾਉਂਦੇ ਹੁੰਦੇ ਸੀ ਜਦੋਂ ਟੀਚਰ ਡੇ ਅਤੇ ਟੀਚਰ ਨੂੰ ਗਿਫਟ ਕਰਨ ਵਾਸਤੇ ਐਂਡ ਮੈਨੂੰ ਹੱਥ ਨਾਲ ਚੀਜ਼ ਬਣਾ ਕੇ ਦੇਣਾ ਜਾਂ ਮਤਲਬ ਬਣਾ ਕੇ ਘਰ ਸਜਾਉਣਾ ਸਜਾਵਟ ਕਰਨੀ ਬੜਾ ਪਸੰਦ ਹੈ ਕਿਉਂਕਿ ਇੱਕ ਤਾਂ ਉਹਦੇ ਨਾਲ ਆਪਣੀ ਕ੍ਰੀਏਟਿਵਿਟੀ ਸ਼ੋਅ ਹੁੰਦੀ ਹੈ ਕਿ ਆਪਾਂ ਕਿੰਨਾ ਕੁ ਚੀਜ਼ਾਂ ਨੂੰ ਯੂਜ ਕਰਕੇ ਪੁਰਾਣੀਆਂ ਚੀਜ਼ਾਂ ਨੂੰ ਯੂਜ ਕਰਕੇ ਕੁਛ ਨਵਾਂ ਕ੍ਰੀਏਟ ਕਰ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਜਦੋਂ ਆਪਾਂ ਬਣਾ ਕੇ ਦਿੰਦੇ ਹਾਂ ਤਾਂ ਆਪਣੇ ਐਫਰਟ ਹੁੰਦੇ ਆ ਉਸ ਚੀਜ਼ ਨੂੰ ਬਣਾਉਣ 'ਚ ਜਦੋਂ ਕਿ ਅਗਰ ਆਪਾਂ ਬਜ਼ਾਰੋਂ ਕੁਝ ਲਿਆ ਕੇ ਦੇ ਦਈਏ ਤਾਂ ਉਹ ਇੰਨਾਂ ਮਤਲਬ ਉਹਦੇ 'ਚ ਆਪਣੇ ਫੀਲਿੰਗਸ ਇੰਨੀ ਸ਼ੋਅ ਨਹੀਂ ਹੁੰਦੀਆਂ ਅਤੇ ਜਦੋਂ ਕਿ ਆਪਾਂ ਜਦੋਂ ਕੁਝ ਹੱਥ ਨਾਲ ਬਣਾ ਕੇ ਦਿੰਦੇ ਹਾਂ ਤਾਂ ਆਪਣੀ ਫੀਲਿੰਗਸ ਆਪਣੀ ਇਮੋਸ਼ਨਸ ਉਹਦੇ 'ਚ ਜ਼ਿਆਦਾ ਆਪਣੇ ਐਫਰਟ ਲੱਗਦੇ ਆ ਅਤੇ ਅਗਲਾ ਬੰਦਾ ਵੀ ਦੇਖ ਕੇ ਪਸੰਦ ਕਰਦਾ ਖੁਸ਼ ਹੁੰਦਾ ਕਿ ਹਾਂ ਬਈ ਆਪਾਂ ਉਹਦੇ ਨਾ ਲਈ ਇੰਨੇ ਕੁ ਐਫਰਟ ਲਾਏ ਹੈ ਗਿਫਟ ਦੇਣ ਲੱਗੇ ਸੋਚਿਆ ਜਿਹੜਾ ਇੱਕ ਥੋਟ ਪ੍ਰੋਸੈਸ ਹੈ ਕਿ ਅਗਲੇ ਬੰਦੇ ਨੂੰ ਕੀ ਪਸੰਦ ਆਵੇਗਾ ਕਿਵੇਂ ਆਪਾਂ ਤਿਆਰ ਕਰਨਾ ਤਾਂ ਉਹ ਚੀਜ਼ ਜ਼ਿਆਦਾ ਮੈਟਰ ਕਰਦੀਆਂ ਨੇ ਬਜਾਏ ਕਿ ਆਪਾਂ ਜਦੋਂ ਕੁਛ ਰੈਡੀਮੇਟ ਲਿਆ ਕੇ ਦਿੰਦੇ ਹਾਂ ਆਪਾਂ ਕੁਛ ਵੀ ਬਣਾ ਕੇ ਦੇ ਸਕਦੇ ਹਾਂ ਜਿਵੇਂ ਗ੍ਰੀਟਿੰਗ ਕਾਰਡ ਜਾਂ ਕੁਛ ਹੱਥ ਤੋਂ ਡਰਾਇੰਗ ਵਗੈਰਾ ਬਣਾ ਕੇ ਜਾਂ ਕੁਛ ਫੋਟੋਗਰਾਫ ਦਾ ਕੁਝ ਬਣਾ ਕੇ ਕੁਛ ਵੀ ਆਪਾਂ ਮਤਲਬ ਆਪਣੇ ਫਰੈਂਡਸ ਜਾਂ ਆਪਣੇ ਫੈਮਲੀ ਮੈਂਬਰ ਨੂੰ ਗਿਫਟ ਦੇ ਸਕਦੇ ਹਾਂ ਜਿਹੜਾ ਕੁਛ ਉਹਨਾਂ ਨੂੰ ਪਸੰਦ ਹੋਵੇ ਧੰਨਵਾਦ